ਜਦੋਂ ਅਸੀਂ ਆਨਲਾਈਨ ਪ੍ਰੋਡੈਕਟ ਮੰਗਾਇਆ ਸੀ ਤਾਂ ਵੇਖ ਕੇ ਸਾਰਾ ਕੁਝ ਵੇਖ ਕੇ ਮੰਗਵਾਇਆ ਸੀ ਕਿ ਉਹਦਾ ਕੁਆਇਲਟੀ ਬੈਸਟ ਹੈ ਕਿ ਨਹੀਂ ਕੀ ਚੀਜ਼ ਹੈ ਕੀ ਨਹੀਂ ਤੇ ਜਦੋਂ ਸਾਨੂੰ ਸਾਰਾ ਸਮਾਨ ਪਤਾ ਲੱਗਿਆ ਕਿ ਇਹ ਵੈਰੀ ਗੁੱਡ ਹੈਗਾ ਵਾ ਤੇ ਅਸੀਂ ਮੰਗਵਾਇਆ ਤੇ ਜਦੋਂ ਸਾਨੂੰ ਉਹ ਪ੍ਰੋਡੈਕਟ ਪ੍ਰਚੇਜ ਹੋਇਆ ਜਾਨੀ ਕਿ ਮਿਲਿਆ ਤੇ ਉਸ ਪ੍ਰੋਡੈਕਟ ਸਾਨੂੰ ਉਹ ਵਾਲਾ ਨਹੀਂ ਮਿਲਿਆ ਜੋ ਅਸੀਂ ਮੰਗਵਾਇਆ ਸੀ ਤੇ ਦੇਖਿਆ ਸੀ ਕਿ ਉਹਦੀ ਕੁਆਲਿਟੀ ਵੀ ਕੋਈ ਗੁੱਡ ਨਹੀਂ ਸੀ ਪਲੀਜ ਸਾਡਾ ਪ੍ਰੋਡਕਟ ਸਾਨੂੰ ਚੇਂਜ ਕਰਕੇ ਦਿੱਤਾ ਜਾਵੇ ਜੋ ਸਮਾਨ ਅਸੀਂ ਮੰਗਵਾਇਆ ਸਾਨੂੰ ਉਹੀ ਹੀ ਮਿਲਣਾ ਚਾਹੀਦਾ ਵਾ ਤੇ ਉਹ ਪ੍ਰੋਡਕਟ ਸਾਰਾ ਹੀ ਖਰਾਬ ਸੀਗਾ ਸਾਰਾ ਸਮਾਨ ਜੋ ਮੰਗਵਾਇਆ ਗਲਤ ਨਿਕਲਿਆ ਤੇ ਨਾ ਹੀ ਉਹਦਾ ਕੋਈ ਸਮਾਨ ਵਧੀਆ ਸੀ ਨਾ ਹੀ ਚੀਜ਼ ਵਧੀਆ ਸੀ ਇਹ ਸਾਡਾ ਸਮਾਨ ਸਾਨੂੰ ਚੇਂਜ ਕਰਕੇ ਵਾਪਸ ਕਰਕੇ ਸਾਨੂੰ ਸਾਰਾ ਸਮਾਨ ਜੋ ਅਸੀਂ ਵੇਖਿਆ ਸੀ ਸਾਨੂੰ ਉਹ ਦੁਬਾਰਾ ਤੋਂ ਭੇਜਿਆ ਜਾਵੇ ਨਹੀਂ ਸਾਡੇ ਇਹ ਪ੍ਰੋਡਕਟ ਐਕਸਪਾਇਰਨੈਸ ਨਿਕਲੇ ਨੇ ਕਿਉਂਕੀ ਜੋ ਅਸੀਂ ਸਮਾਨ ਮੰਗਵਾਇਆ ਉਹ ਤਰੀਕ ਤੋਂ ਕਾਫੀ ਵੱਧ ਕੇ ਐਕਸਪਾਇਰ ਸੀ ਤੇ ਨਾ ਹੀ ਸਾਨੂੰ ਟਾਈਮ ਤੇ ਮਿਲਿਆ ਸੀ